ਨਮਸਤੇ ਸਰ ਮੈਂ ਪਰਮਜੀਤ ਕੌਰ ਤੁਹਾਡੇ ਰੈਸਟੋਰੈਂਟ ਤੋਂ ਕਈ ਚੀਜ਼ਾਂ ਮੰਗਵਾ ਰਹੀ ਹਾਂ ਜਿਨ੍ਹਾਂ ਵਿੱਚ ਕੜੀ ਚਾਵਲ ਮਾਂਹ ਦਾਲ ਮੱਖਣੀ ਭਟੂਰੇ ਛੋਲੇ ਬੁਕ ਕਰਵਾਏ ਸਨ ਇਸ ਤੋਂ ਇਲਾਵਾ ਮੈਂ ਕੁਛ ਹੋਰ ਚੀਜ਼ਾਂ ਖਾਣ ਪੀਣ ਵਾਲੀਆਂ ਵਸਤੂਆਂ ਜਿਵੇਂ ਕਿ ਚਾਈਨੀਜ਼ ਖਾਣਾ ਬਰਗਰ ਨਿਊਡਲ ਟਿੱਕੀ ਵਗੈਰਾ ਮ ਮੰਗਵਾਉਣਾ ਚਾਹੁੰਦੀ ਹਾਂ ਉਹ ਕੁਝ ਚੀਜ਼ਾਂ ਰਹਿ ਗਈਆਂ ਸਨ ਇਸ ਲਈ ਮੈਨੂੰ ਉਸਦੇ ਖਾਣ ਦੇ ਲਈ ਪੀਣ ਵਾਲੀ ਚੀਜ਼ਾਂ ਵਿੱਚ ਕੋਲਡ ਡਰਿੰਕ ਲਿਮਕਾ ਵਗੈਰਾ ਅਤੇ ਕੁਝ ਬੱਚਿਆਂ ਵਾਲੀਆਂ ਵਸਤੂਆਂ ਭੇਜ ਦਿਓ ਜਿਵੇਂ ਫਰੂਟੀ ਫਰੂਟੀ ਵਗੈਰਾ ਉਹ ਚਿਪਸ ਅਤੇ ਕੁਝ ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਬੱਚਿਆਂ ਦੇ ਵਾਸਤੇ ਭੇਜ ਦਿੰਦੇ ਹੋ ਅਤੇ ਜੋ ਵੀ ਤੁਸੀਂ ਸਮਾਨ ਭੇਜੋਗੇ ਤਾਂ ਉਹ ਮੇ ਮੈਨੂੰ ਮਤਲਬ ਕਿ ਪਹੁੰਚ ਜਾਵੇ ਅਤੇ ਮੈਂ ਤੁਹਾਡਾ ਮਤਲਬ ਔਨਲਾਈਨ ਪੇਮੈਂਟ ਕਰਦਾਂ ਜਾਂ ਮਤਲਬ ਕਿ ਹੱਥੀਂ ਪੇਮੈਂਟ ਕਰਦਾਂ ਇਸ ਤੋਂ ਲਈ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ